ਭਾਰਤ ਦਾ ਫੈਸ਼ਨ ਪੂਰੇ ਵਿਸ਼ਵ ਭਰ ਵਿੱਚ ਬਹੁਤ ਹੀ ਪ੍ਰਸਿੱਧ ਹੈ ਅਤੇ ਮੰਨਿਆ ਜਾਣ ਵਾਲਾ ਹੈ ਮੈਨੂੰ ਮਾਣ ਹੈ ਕਿ ਮੈਂ ਭਾਰਤ ਦੀ ਵਾਸੀ ਹਾਂ ਇੱਥੇ ਜਦੋਂ ਵਿਦੇਸ਼ ਤੋਂ ਲੋਕ ਆਉਂਦੇ ਨੇ ਤਾਂ ਉਹ ਭਾਰਤੀ ਪਹਿਨਾਵਾ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਖੁਦ ਵੀ ਉਹ ਪਹਿਨਾਵਾ ਪਹਿਨਣਾ ਪਸੰਦ ਕਰਦੇ ਹਨ ਜੀ ਹਾਂ ਬਿਲਕੁਲ ਮੈਨੂੰ ਲੱਗਦਾ ਹੈ ਕਿ ਕੱਪੜੇ ਪਹਿਲਾਂ ਦੇ ਮੁਕਾਬਲੇ ਬਦਲੇ ਹੋਏ ਨੇ ਔਰਤਾਂ ਨੂੰ ਜੋ ਪਹਿਲਾਂ ਸ ਸ਼ਰਮ ਪਹਿਲੇ ਸਮੇਂ ਵਿੱਚ ਲਾਜ ਸ਼ਰਮ ਸੀ ਉਹ ਹੌਲੀ ਹੌਲੀ ਵਿਸਰਦੀ ਜਾ ਰਹੀ ਹੈ ਜਿਵੇਂ ਜਿਵੇਂ ਪਹਿਲੇ ਚੁੰਨੀ ਸਿਰ ਤੋਂ ਲੱ ਲੱਥਦੀ ਨਹੀਂ ਸੀ ਹੁੰਦੀ ਅਤੇ ਪਤਾ ਨਹੀਂ ਸਿਰ ਤੋਂ ਮੋਢੇ 'ਤੇ ਕਦੋਂ ਆਈ ਅਤੇ ਮੋਢੇ ਤੋਂ ਵਿਸਰਦੀ ਵਿਸਰਦੀ ਪਤਾ ਹੀ ਨਹੀਂ ਲੱਗਿਆ ਕਿ ਕਿੱਥੇ ਗੁਆਚ ਗਈ ਪੱਛਮੀ ਫੈਸ਼ਨ ਅਤੇ ਭਾਰਤ ਵਿੱਚ ਫੈਸ਼ਨ ਬਹੁਤ ਬਹੁਤ ਪ੍ਰਾਚੀਨ ਬਹੁਤ ਬਹੁਤ ਲੋਕ ਸੱਭਿਆਚਾਰਕ ਭੁੱਲ ਇਹ ਵਾਲਾ ਫੈਸ਼ਨ ਜਿਹੜਾ ਸੱਭਿਆਚਾਰਕ ਦਾ ਭੁੱਲਦੇ ਜਾ ਰਹੇ ਨੇ ਭੁੱਲਦੇ ਜਾ ਰਹੇ ਨੇ ਅਤੇ ਪੱਛਮੀ ਫੈਸ਼ਨ ਵੱਲ ਆਕਰਸ਼ਿਤ ਹੁੰਦੇ ਜਾ ਰਹੇ ਹਨ ਮੈਂ ਅੱਜ ਵੀ ਕਿਸੇ ਵੀ ਖ਼ਾਸ ਫੰਕਸ਼ਨ 'ਤੇ ਜਾਂ ਤਿਉਹਾਰ 'ਤੇ ਸੱਭਿਆਚਾਰਕ ਕੱਪੜੇ ਪਾਉਣਾ ਹੀ ਪਸੰਦ ਕਰਦੀ ਹਾਂ ਕਿਉਂਕਿ ਇਹ ਸਾਡੇ ਭਾਰਤ ਦੀ ਪਹਿਚਾਣ ਹੈ ਸਾਡੇ ਭਾਰਤ ਵਿੱਚ ਸਾਡੇ ਸਾਡੇ ਤਰਨ ਤਾਰਨ ਵਿੱਚ ਨਾ ਅਰਬਨ ਪੰਜਾਬ ਮੌਲ ਹੈ ਜਿੱਥੋਂ ਅਸੀਂ ਪੰਜਾਬੀ ਕੱਪੜੇ ਖਰੀਦਦੇ ਹਾਂ ਉੱਥੇ ਹਰ ਤਰ੍ਹਾਂ ਦੀਆਂ ਵਰਾਇਟੀਆਂ ਪੰਜਾਬੀ ਮਿਲ ਜਾਂਦੀਆਂ ਨੇ ਕਿਸੇ ਵੀ ਫੰਕਸ਼ਨ 'ਤੇ ਪਾਉਣ ਵਾਸਤੇ ਮੈਂ ਉੱਥੋਂ ਜ਼ਿਆਦਾਤਰ ਸ਼ੋਪਿੰਗ ਕਰਨਾ ਪਸੰਦ ਕਰਦੀ ਹਾਂ